ਖੇਡਾਂ ਦਾ ਕੋਈ ਇੱਕ ਫਾਇਦਾ ਜਿਹੜਾ ਉਹ ਸਾਨੂੰ ਨਹੀਂ ਹੈ ਇਹਦੇ ਬਹੁਤ ਸਾਰੇ ਫਾਇਦੇ ਨੇ ਅਗਰ ਹੁਣ ਦੇ ਮਨੁੱਖ ਦੀ ਗੱਲ ਕਰੀਏ ਤਾਂ ਮਨੁੱਖ ਦੀ ਜਿਹੜੀ ਜ਼ਿੰਦਗੀ ਹੈ ਉਹ ਬਹੁਤ ਸਾਰੇ ਸਟਰੈਸ ਦੇ ਨਾਲ ਟੈਨਸ਼ਨਾਂ ਨਾਲ ਪਰੇਸ਼ਾਨੀਆਂ ਦੇ ਨਾਲ ਕਹਿ ਲਓ ਭਰੀ ਪਈ ਹੈ ਔਰ ਜਦੋਂ ਇੱਕ ਇਨਸਾਨ ਇੱਕ ਬੱਚਾ ਇੱਕ ਜਵਾਨ ਆਪਣੇ ਮਨ ਨੂੰ ਕਿਸੇ ਹੋਰ ਪਾਸੇ ਨਹੀਂ ਲਾਉਂਦਾ ਤਾਂ ਇਹ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਕਿਤੇ ਨਾ ਕਿਤੇ ਜਿਹੜਾ ਡਿਪਰੈਸ਼ਨ ਹੈ ਉਹਦਾ ਕਾਰਨ ਬਣ ਜਾਂਦੀਆਂ ਨੇ ਔਰ ਮਨੁੱਖ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਰਸ ਨੂੰ ਇਹ ਪੂਰੀ ਤਰ੍ਹਾਂ ਖ਼ਤਮ ਕਰ ਦਿੰਦੀਆਂ ਨੇ ਨਾ ਤਾਂ ਫਿਰ ਉਹ ਚਾਹੇ ਬੱਚਾ ਹੋਵੇ ਜਵਾਨ ਹੋਵੇ ਜਾਂ ਬਜ਼ੁਰਗ ਹੋਵੇ ਨਾ ਉਹ ਹੱਸ ਖੇਡ ਸਕਦਾ ਹੈ ਨਾ ਕਿਸੇ ਖੁਸ਼ ਖੁਸ਼ੀ ਦੀ ਖ਼ਬਰ ਦੇ ਵਿੱਚ ਉਹ ਖੁਸ਼ ਹੁੰਦਾ ਹੈ ਨਾ ਦੁੱਖ ਦੀ ਖ਼ਬਰ ਦੇ ਵਿੱਚ ਉਹ ਦੁੱਖ ਨੂੰ ਮਹਿਸੂਸ ਕਰ ਪਾਉਂਦਾ ਹੈ ਤਾਂ ਇਹਨਾਂ ਸਾਰੀਆਂ ਪਰੇਸ਼ਾਨੀਆਂ ਦੇ ਵਿੱਚੋਂ ਅਗਰ ਅਸੀਂ ਨਿਕਲਣਾ ਚਾਹੁੰਦੇ ਹਾਂ ਤਾਂ ਖੇਡਾਂ ਇੱਕ ਇਹੋ ਜਿਹਾ ਹਥਿਆਰ ਹੈ ਕਿ ਇੱਕ ਪਾਸੇ ਤਾਂ ਇਹ ਤੁਹਾਡੀ ਟੈਨਸ਼ਨ ਨੂੰ ਦੂਰ ਕਰਦਾ ਹੈ ਤੁਹਾਡੇ ਡਿਪ੍ਰੈਸ਼ਨ ਨੂੰ ਦੂਰ ਕਰਦਾ ਹੈ ਦੂਜੇ ਪਾਸੇ ਇਹ ਤੁਹਾਨੂੰ ਮਨੋਰੰਜਨ ਜਿਹੜਾ ਹੈ ਉਹ ਵੀ ਦਿੰਦਾ ਹੈ ਹੁਣ ਉਹ ਕਿਵੇਂ ਕੋਈ ਬੱਚਾ ਅਗਰ ਪੜ੍ਹਾਈ ਦੀ ਪਰੇਸ਼ਾਨੀ ਲੈਂਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਉਹਨੂੰ ਪਰੇਸ਼ਾਨੀ ਹੈ ਜਦੋਂ ਆਪਣੇ ਯਾਰਾਂ ਮਿੱਤਰਾਂ ਦੋਸਤਾਂ ਦੇ ਨਾਲ ਉਹ ਖੇਡ ਮੈਦਾਨ ਦੇ ਵਿੱਚ ਖੇਡਦਾ ਹੈ ਤਾਂ ਉਹਦਾ ਜਿਹੜਾ ਸਰੀਰ ਹੈ ਉਹ ਇੱਕ ਹੋਰ ਹਰਕਤ ਦੇ ਵਿੱਚ ਆਉਂਦਾ ਹੈ ਕਿਹੜੀ ਹਰਕਤ ਕਿ ਉਹ ਖੇਡਣ ਵਿੱਚ ਆਪਣਾ ਜਿਹੜੀ ਐਨਰਜੀ ਹੈ ਉਹ ਸਾਰੀ ਲਗਾ ਦਿੰਦਾ ਹੈ ਜਿਹੜੀ ਵਾਧੂ ਸ਼ਕਤੀ ਉਹ ਸੋਚਣ ਵਿਚਾਰਨ ਅਤੇ ਟੈਂਸ਼ਨ ਲੈਣ ਦੇ ਵਿੱਚ ਬਿਤਾਉਂਦਾ ਹੈ ਉਹ ਸਾਰੀ ਐਨਰਜੀ ਉਹ ਖੇਡਾਂ ਦੇ ਵਿੱਚ ਲਗਾ ਦਿੰਦਾ ਹੈ ਔਰ ਜਿਹੜਾ ਜਿਹੜੀ ਟੈਨਸ਼ਨ ਹੈ ਜਿਹੜਾ ਸੋਚ ਹੈ ਚਿੰਤਨ ਹੈ ਉਹ ਆਪਣੇ ਆਪ ਉਹਦੇ ਤੋਂ ਦੂਰ ਜਿਹੜਾ ਹੈ ਉਹ ਨੱਸ ਜਾਂਦਾ ਹੈ ਤਾਂ ਹਰ ਉਹ ਇਨਸਾਨ ਜਿਹੜਾ ਖੇਡਾਂ ਦੇ ਵਿੱਚ ਆਪਣੀ ਸਰੀਰਕ ਸ਼ਕਤੀ ਲਾਉਂਦਾ ਹੈ ਉਹ ਇਨਸਾਨ ਤੰਦਰੁਸਤ ਵੀ ਹੁੰਦਾ ਹੈ ਦਿਮਾਗੀ ਤੌਰ 'ਤੇ ਵੀ ਉਹ ਤਾਕਤਵਰ ਹੁੰਦਾ ਹੈ ਦੂਜੇ ਲੋਕਾਂ ਨਾਲੋਂ ਕੋਈ ਡਿਸੀਜ਼ਨ ਲੈਣਾ ਹੋਵੇ ਤਾਂ ਉਹ ਡਿਸੀਜ਼ਨ ਵੀ ਬਹੁਤ ਵਧੀਆ ਆਪਣੀ ਜ਼ਿੰਦਗੀ ਦੇ ਵਿੱਚ ਲੈਂਦਾ ਹੈ ਕਿਉਂ ਕਿਉਂਕਿ ਉਹਦਾ ਪੂਰਾ ਸਰੀਰ ਸਿਰ ਤੋਂ ਲੈ ਕੇ ਪੈਰਾਂ ਤੱਕ ਤੰਦਰੁਸਤ ਹੈ ਔਰ ਤੰਦਰੁਸਤ ਜਿਹੜਾ ਇਨਸਾਨ ਹੈ ਇਹੋ ਜਿਹੇ ਇਨਸਾਨ ਦੇ ਵਿੱਚ ਜਿਹੜਾ ਦਿਮਾਗ ਹੈ ਉਹ ਤੰਦਰੁਸਤ ਹੀ ਹੁੰਦਾ ਹੈ ਤੰਦਰੁਸਤ ਸਰੀਰ ਦੇ ਵਿੱਚ ਹਮੇਸ਼ਾ ਤੰਦਰੁਸਤ ਦਿਮਾਗ ਦਾ ਹੀ ਨਿਵਾਸ ਹੁੰਦਾ ਹੈ ਸੋ ਖੇਡਾਂ ਦੇ ਇੱਕ ਨਹੀਂ ਬਹੁਤ ਸਾਰੇ ਫਾਇਦੇ ਨੇ ਟੈਨਸ਼ਨ ਦੂਰ ਕਰਦੀਆਂ ਨੇ ਮਨੋਰੰਜਨ ਪ੍ਰਦਾਨ ਕਰਦੀਆਂ ਨੇ ਆਪਸੀ ਭਾਈਚਾਰਾ ਬਣਾਉਂਦੀਆਂ ਨੇ ਔਰ ਇਨਸਾਨ ਨੂੰ ਤੰਦਰੁਸਤ ਵੀ ਬਣਾਉਂਦੀਆਂ ਨੇ